ਹਾਂ ਬਾਈ ਜੀ ਤੁਸੀਂ ਸਿੱਧੂ ਸਟੂਡੀਓ ਬਰਨਾਲਾ ਤੋਂ ਬੋਲਦੇ ਹੋ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਵੀਰੇ ਅਸੀਂ ਨਾ ਖੁੱਡੀ ਕਲਾਂ ਤੋਂ ਬੋਲਦੇ ਆਗੇ ਇੱਥੇ ਹੰਢਾਏ ਦੇ ਨੇੜਿਓਂ ਹਾਂਜੀ ਹਾਂਜੀ ਅਤੇ ਇੱਥੇ ਨਾ ਜਿਹੜਾ ਕੀ ਆ ਸਾਡੇ ਨਾਲ ਗਵਾਂਢ 'ਚ ਵਿਆਹ ਹੋਇਆ ਸੀਗਾ ਉਹਨਾਂ ਦੇ ਨਾ ਤੁਹਾ ਤੁਹਾਨੂੰ ਹੀ ਬੁੱਕ ਕੀਤਾ ਸੀ ਮਹੀਨਾ ਕੁ ਹੋ ਗਿਆ ਆਹ ਜੈਲਦਾਰਾਂ ਦੇ ਵਿਆਹ ਸੀਗਾ ਹਾਂਜੀ ਹਾਂਜੀ ਅਤੇ ਉਹਨਾਂ ਨੇ ਤੁਹਾਨੂੰ ਜਿਹੜਾ ਤੁਹਾਡਾ ਕੰਮ ਨਾ ਅਸੀਂ ਉਹਨਾਂ ਨੇ ਸਾਨੂੰ ਪ੍ਰੀ ਵੈਡਿੰਗ ਦਿਖਾਈ ਜਦ ਐਲਬਮ ਜਦ ਬਹੁਤ ਵਧੀਆ ਤੁਹਾਡਾ ਸਾਨੂੰ ਕੰਮ ਲੱਗਿਆ ਅਤੇ ਹਾਂਜੀ ਮੇਰੇ ਨਾ ਛੋਟੇ ਭਰਾ ਦੀ ਮੈਰਿਜ ਹੈਗੀ ਜੀ ਦਸੰਬਰ ਦੇ ਵਿੱਚ ਹੈਗੀ ਪੱਚੀ ਕੁ ਦਸੰਬਰ ਦੇ ਆਸ ਵੀ ਸਮਝ ਲਓ ਕਿ ਸਾਨੂੰ ਚਾਹੀਦਾ ਇੱਕ ਇੱਕੀ ਤਰੀਕ ਤੋਂ ਲੈ ਕੇ ਪੱਚੀ ਤੀਕਰ ਸਾਨੂੰ ਸਾਡਾ ਕੰਮ ਹੈਗਾ ਵੀ ਉਹ ਪੁੱਛਦੇ ਸੀਗੇ ਵੀ ਕੀ ਤੁਸੀਂ ਫਰੀ ਹੋਗੇ ਇਹ ਡੇਟਾਂ ਦੇ ਵਿੱਚ ਹਾਂਜੀ ਹਾਂਜੀ ਵੀਰੇ ਸਾਡੇ ਇੱਕੀ ਤੋਂ ਫੰਕਸ਼ਨ ਸ਼ੁਰੂ ਹੋ ਜਾਣਗੇ ਊਂ ਵਿਆਹ ਸਾਡਾ ਪੱਚੀ ਦਾ ਹੈਗਾ ਹਾਂਜੀ ਪੱਚੀ ਦਿਸੰਬਰ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਜੀ ਅੱਛਾ ਜੀ ਅੱਛਾ ਹਾਂਜੀ ਉਹ ਅਸੀਂ ਪਾਠ ਪ੍ਰਕਾਸ਼ ਕਰਾਉਣਾ ਹੈਗਾ ਵੀ ਨਾਲ ਤਾਂ ਉਹ ਹਾਂ ਹਾਂਜੀ ਹਾਂਜੀ ਚਲੋ ਹਾਂ ਉਦੋਂ ਭਾਵੇਂ ਘੱਟ ਮੁੰਡੇ ਭੇਜ ਦਿਓ ਘੱਟ ਨਾਲ ਸਾਰ ਲਾਂਗੇ ਹਾਂ ਬਸ ਬਸ ਜਿਹੜੀ ਤੁਹਾਡੀ ਕੁਆਲਿਟੀ ਕਰਕੇ ਹੀ ਸਾਨੂੰ ਐਂ ਵੀ ਜਿਹੜਾ ਵੀ ਚਲੋ ਵਧੀਆ ਤੁਹਾਡੇ ਕੋਲ ਕਰਵਾ ਲਈਏ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਸਰ ਕੋਈ ਪ ਅਤੇ ਪ੍ਰੀ ਵੈਡਿੰਗ ਜੇ ਕਰ ਦੋਂਗੇ ਹੈ ਨਾ ਵੀ ਜੇ ਪਹਿਲਾਂ ਵੇਖ ਲਓ ਜਾਂ ਤੁਹਾਡਾ ਹੈਗਾ ਬਾਈ ਨੂੰ ਤੁਸੀਂ ਬੁੱਕ ਹੋਗੇ ਆਹ ਸੌਲ੍ਹਾਂ ਹੁਣ ਦੇਖੋ ਨਵੰਬਰ ਚੱਲੀ ਜਾਂਦਾ ਕਾਫੀ ਦਿਨ ਪਏ ਪ੍ਰੀ ਵੈਡਿੰਗ ਲਈ ਵੀ ਇੱਕ ਦਿਨ ਕੱਢ ਲਓ ਪ੍ਰੀ ਵੈਡਿੰਗ ਵੀ ਕਰ ਦਿਓ ਉਹਨਾਂ ਦੀ ਅੱਛਾ ਜੀ

ਅੱਛਾ ਅੱਛਾ ਅੱਛਾ ਜੀ ਹਾਂ ਹਾਂਜੀ ਸਰ ਜਿਵੇਂ ਉਹ ਨਹੀਂ ਘਰੇਲੂ ਜਿਹੇ ਘਰੇਲੂ ਜੇ ਜਿਵੇਂ ਉਹ ਛੱਪਰ ਜਿਹੇ ਬਣੇ ਹੁੰਦੇ ਆ ਅਤੇ ਪਾਣੀ ਖੂਹ 'ਚੋਂ ਪਾਣੀ ਭਰਦੇ ਆ ਨਾ ਉਹ ਚੀਜ਼ਾਂ ਹੀ ਆ ਪੇਂਡੂ ਕਲਚਰ ਜਿਹਾ ਦਿਖਦਾ ਹੋਵੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ

ਠੀਕ ਹੈ ਜੀ ਠੀਕ ਹੈ ਸਰ ਅੱਛਾ ਜੀ ਜੀ ਸਰ ਜੀ ਠੀਕ ਹੈ ਸਰ ਇਹ ਸਰ ਕੋਈ ਇਸ ਤੁਸੀਂ ਲੈਸ ਲੁਸ ਦਾ ਕਿਵੇਂ ਕਰੋਗੇ

ਹਾਂਜੀ ਹਾਂਜੀ ਅੱਛਾ ਅੱਛਾ ਜੀ ਅੱਛਾ ਜੀ ਠੀਕ ਹੈ ਸਰ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਨਹੀਂ ਨਹੀਂ ਹਾਂ ਨਹੀਂ ਬਿਲਕੁਲ ਮੈਂ ਸਮਝਦਾ ਜੀ ਉਹ ਤਾਂ ਸਹੀ ਗੱਲ ਹੈ ਤੁਹਾਡੀ ਹਾਂਜੀ ਠੀਕ ਬਿਲਕੁਲ ਬਿਲਕੁਲ ਜੀ ਠੀਕ ਹੈ ਸਰ ਹਾਂਜੀ ਜੀ ਜੀ ਜੀ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਸਰ ਥੈਂਕ ਯੂ ਜੀ ਮੈਂ ਕੱਲ੍ਹ ਨੂੰ ਆ ਕੇ ਜਾਊਂਗਾ ਜੀ ਤੁਹਾਡੇ ਕੋਲ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਜੀ